ਹੈਲੋ ਹਾਂਜੀ ਸਵਿਗੀ ਹੈਲਪਲਾਈਨ ਤੋਂ ਬੋਲ ਰਹੇ ਹੋ ਜੀ ਹਾਂਜੀ ਸਰ ਤੁਹਾਡਾ ਮੈਸੇਜ ਆ ਰਿਹਾ ਕਿ ਮੇਰੇ ਕਾਰਟ ਦੇ ਵਿੱਚ ਸਮਾਨ ਪਿਆ ਅਤੇ ਤੁਸੀਂ ਔਡਰ ਕਿਉਂ ਨਹੀਂ ਪਲੇਸ ਕਰ ਰਹੇ ਔਡਰ ਮੈਂ ਪਲੇਸ ਕੀਤਾ ਸੀ ਸਰ ਮੈਂ ਹਾਂਜੀ ਲਾਈਫ ਬੇਕਰੀ ਤੋਂ ਪੈਟੀਜ ਕੇਕ ਅਤੇ ਪੀਜੇ ਦਾ ਔਡਰ ਕੀਤਾ ਸੀ ਜਿਸ ਦੀ ਕੁੱਲ ਰਕਮ ਲਗਭਗ ਸਾਢੇ ਗਿਆਰਾਂ ਸੌ ਰੁਪਇਆ ਬਣੀ ਅਤੇ ਔਡਰ ਨੰਬਰ ਵੀ ਸ਼ੋਅ ਹੋ ਰਿਹਾ ਸੀ ਇੱਕ ਜ਼ੀਰੋ ਛੇ ਛੇ ਨੌ ਸੱਤ ਪਰ ਤੁਸੀਂ ਕਹਿ ਰਹੇ ਹੋ ਕਿ ਮੈਂ ਔਡਰ ਪਲੇਸ ਫਾਈਨਲ ਪਲੇਸ ਨਹੀਂ ਕੀਤਾ ਉਹਦੀ ਉਹਦਾ ਰੀਜ਼ਨ ਇਹ ਹੈ ਜੀ ਕਿ ਮੇਰੇ ਕੋਲ ਜਿਹੜਾ ਵੀ ਕੋਈ ਵਿਕਲਪ ਆ ਰਿਹਾ ਸੀ ਪੇਮੈਂਟ ਦਾ ਉਹ ਸਿਰਫ ਔਨਲਾਈਨ ਪੇਮੈਂਟ ਦਾ ਆ ਰਿਹਾ ਸੀ ਜਾਂ ਐਡਵਾਂਸ ਪੇਮੈਂਟ ਦਾ ਜਿਸ ਦੇ ਵਿੱਚ ਨੈੱਟ ਬੈਂਕਿੰਗ ਵੀ ਦਿੱਤੀ ਹੋਈ ਹੈ ਤੁਸੀਂ ਕੈਸ਼ ਜਾਂ ਕਾਰਡ ਤੋਂ ਵੀ ਕਾਰਡ ਪੇਮੈਂਟ ਦਾ ਵੀ ਕਿਹਾ ਹੋਇਆ ਅਤੇ ਨਾਲ ਦੂਸਰੀ ਵੀ ਆਪਸ਼ਨ ਦਿੱਤੀ ਨੈਟ ਬੈਂਕਿੰਗ ਦੀ ਪਰ ਜਿਹੜੀ ਸੀ ਓ ਡੀ ਆ ਜਿਹਨੂੰ ਕੈਸ਼ ਆਨ ਡਿਲੀਵਰੀ ਜਾਂ ਡਿਲੀਵਰੀ 'ਤੇ ਨਕਦ ਦੀ ਆਪਸ਼ਨ ਆ ਉਹ ਆਪਸ਼ਨ ਐਕਟੀਵੇਟ ਹੀ ਨਹੀਂ ਹੈ ਸਰ ਮੈਂ ਸਮਝਦਾ ਕਿ ਮੈਂ ਜੇ ਔਡਰ ਕੀਤਾ ਤਾਂ ਮੇਰੀ ਤਸੱਲੀ ਹੋਵੇ ਮੈਂ ਔਡਰ ਤਾਂ ਹੀ ਲਵਾਂਗਾ ਕਿਉਂਕਿ ਇੱਕ ਵਾਰੀ ਪਿ ਪਹਿਲਾਂ ਵੀ ਕਿਤੇ ਔਡਰ ਆਇਆ ਸੀ ਅਤੇ ਕੇਕ ਜਿਹੜਾ ਸੀ ਉਹ ਸਾਰਾ ਟੁੱਟਾ ਫੁੱਟਾ ਦੇ ਗਿਆ ਮੈਂ ਪੇਮੈਂਟ ਜਦੋਂ ਐਡਵਾਂਸ ਕਰ ਦਿੱਤੀ ਆ ਉਹ ਕੇਕ ਵਾਪਸ ਲੈ ਕੇ ਜਾਣ ਤੋਂ ਵੀ ਮਨ੍ਹਾ ਕਰ ਰਿਹਾ ਸੀ ਅਤੇ ਇਸ ਵਾਰੀ ਮੈਂ ਨਹੀਂ ਚਾਹੁੰਦਾ ਕਿ ਮੈਨੂੰ ਉਸੇ ਤਰ੍ਹਾਂ ਦੀ ਫਿਰ ਹਰਾਸਮੈਂਟ ਹੋਵੇ ਇਸ ਲਈ ਪਲੀਜ਼ ਤੁਹਾਨੂੰ ਮੈਂ ਬੇਨਤੀ ਕਰਦਾ ਕਿ ਜਿਹੜਾ ਮੈਂ ਔਡਰ ਕਾਰਟ ਦੇ ਵਿੱਚ ਰੱਖਿਆ ਹੋਇਆ ਉਸ ਨੂੰ ਰੱਦ ਕੀਤਾ ਜਾਵੇ ਅਤੇ ਜਾਂ ਫਿਰ ਮੈਨੂੰ ਆਪਸ਼ਨ ਦਿੱਤੀ ਜਾਵੇ ਕਿ ਮੈਂ ਡਿਲੀਵਰੀ 'ਤੇ ਨਕਦ ਪੇਮੈਂਟ ਦੇ ਕੇ ਉਸ ਔਡਰ ਨੂੰ ਲੈ ਲਵਾਂ ਇਹਦੇ ਨਾਲ ਇਹ ਵੀ ਹੈ ਕਿ ਉਸ ਬੰਦੇ ਦੀ ਰਿਸਪੋਂਸੀਬਿਲਿਟੀ ਬਣੇਗੀ ਕਿ ਉਹ ਔਡਰ ਠੀਕ ਤਰੀਕੇ ਨਾਲ ਲੈ ਕੇ ਆਵੇ ਕਿਉਂਕਿ ਉਹਨੇ ਜੇ ਪੈਸੇ ਲੈਣੇ ਆ ਜੇ ਐਡਵਾਂਸ ਪੇਮੈਂਟ ਆ ਜਾਂਦੀ ਹੈ ਅਗਲਾ ਸੋਚਦਾ ਕਿ ਕੋਈ ਗੱਲ ਨਹੀਂ ਜਿੱਦਾਂ ਮਰਜ਼ੀ ਲੈ ਜੀਏ ਇਸ ਕਰਕੇ ਪਲੀਜ਼ ਇਹ ਜਿਹੜਾ ਲਾਈਫ ਬੇਕਰੀ ਤੋਂ ਮੇਰਾ ਔਡਰ ਉਸ ਨੂੰ ਕੈਂਸਲ ਕੀਤਾ ਜਾਵੇ ਸਰ ਥੈਂਕ ਯੂ ਜੀ